ਮੇਰਾ ਮਨ ਪਸੰਦ ਰਸਾਲਾ ਹੈ ਉਹ ਜਿਹੜੀ ਸੰਸਥਾ ਉਹ ਸਾਡੀ ਆਰਕੀਟੈਕਚਰ ਦੀ ਬੱਚਿਆਂ ਦੀ ਜਿਹੜੀ ਉਹ ਹੈ ਸੰਸਥਾ ਹੈ ਨਾਸਾ ਇੰਡੀਆ ਉਸਦਾ ਜਿਹੜਾ ਸਲਾਨਾ ਰਸਾਲਾ ਹੈ ਉਹ ਮੇਰਾ ਮਨ ਪਸੰਦ ਹੈ ਕਿਉਂਕਿ ਉਸ ਦੇ ਵਿੱਚ ਵੱਖ ਵੱਖ ਖੇਤ ਵੱਖ ਵੱਖ ਸੂਬਿਆਂ ਦੇ ਬੱਚੇ ਹਨ ਜੋ ਕਿ ਕਿਉਂਕਿ ਪੂਰੇ ਭਾਰਤ ਦੇ ਬੱਚੇ ਹਨ ਦੇ ਦੀ ਜਿਹੜੀ ਜਿੰਨੇ ਵੀ ਆਰਕੀਟੈਕਚਰ ਜਾ ਕਾਲਜ ਹਨ ਉਹ ਇਸ ਰਸਾਲੇ ਦੇ ਵਿੱਚ ਹਿੱਸਾ ਪਾਉਂਦੇ ਹਨ ਉਹਨਾਂ ਦੀਆਂ ਕੰਮ ਹੈ ਚਾਹੇ ਉਹਨਾਂ ਵਿੱਚ ਦਰਸ਼ਾਇਆ ਜਾਂਦਾ ਹੈ ਤਾਂ ਮੈਨੂੰ ਉਹ ਰਸਾਲੇ ਉਹ ਰਸਾਲਾ ਬਹੁਤ ਪਸੰਦ ਹੈ ਕਿਉਂਕਿ ਉਸ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਬੱਚਿਆਂ ਦਾ ਕੰਮ ਹੈ ਜੋ ਕਿ ਤੇ ਉਹਨਾਂ ਦੀ ਕਲਾ ਹੈ ਉਸ ਨੂੰ ਦੇਖ ਸਕਦਾ ਹਾਂ ਤੇ ਉਸ ਬਾਰੇ ਜਾਣਕਾਰੀ ਲੈ ਸਕਦਾ ਹਾਂ